ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਰੁਜ਼ਗਾਰ ਜਾਂ ਰੋਜ਼ੀ ਰੋਟੀ ਦੇ ਜਿਹੜੇ ਮੁੱਖ ਸਰੋਤ ਹਨ ਜਾਂ ਇੱਥੋਂ ਦੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਖੇਤੀਬਾੜੀ ਜਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਆਪਣੇ ਬਿਜਨਸ ਨੇ ਜਿਹਦੇ ਵਿੱਚ ਉਹਨਾਂ ਦੀਆਂ ਦੁਕਾਨਾਂ ਆ ਜਾਂਦੀਆਂ ਜਾਂ ਕੁਛ ਲੋਕ ਜਿਹੜੇ ਨੇ ਉਹ ਫੈਕਟਰੀਆਂ ਦੇ ਵਿੱਚ ਲੱਗੇ ਹੋਏ ਨੇ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੋਂ ਦੇ ਸਰਕਾਰੀ ਨੌਕਰੀਆਂ ਅਤੇ ਪ੍ਰਾਈਵੇਟ ਨੌਕਰੀਆਂ ਵਾਲੇ ਤਾਂ ਸਰਕਾਰੀ ਨੌਕਰੀਆਂ ਨਾਲੋਂ ਵੀ ਜ਼ਿਆਦਾ ਨੇ ਇਸ ਜ਼ਿਲ੍ਹੇ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਨੇ ਕਿਸੇ ਨਾ ਕਿਸੇ ਕੰਮ ਧੰਦੇ ਦੇ ਵਿੱਚ ਜਿਹੜੇ ਰੁਝੇ ਹੋਏ ਨੇ ਆਪਣੀ ਆਪਣੀ ਸੁਵਿਧਾ ਦੇ ਅਨੁਸਾਰ ਜੋ ਜੋ ਜਿਹਦਾ ਬਿਜਨਸ ਹੈ ਜਿਵੇਂ ਅਗਰ ਕੋਈ ਖੇਤੀਬਾੜੀ ਕਰਨ ਵਾਲਾ ਹੈ ਤਾਂ ਜ਼ਰੂਰੀ ਨਹੀਂ ਕਿ ਉਸ ਪਰਿਵਾਰ ਦੇ ਵਿੱਚ ਸਾਰੇ ਖੇਤੀਬਾੜੀ ਕਰਦੇ ਨੇ ਕੁਛ ਉਹਨਾਂ ਵਿੱਚੋਂ ਨੌਕਰੀਆਂ 'ਤੇ ਲੱਗੇ ਹੋਏ ਨੇ ਇਸ ਜ਼ਿਲ੍ਹੇ ਦੀ ਖਾਸੀਅਤ ਜਿਹੜੀ ਹੈ ਉਹ ਮੈਨੂੰ ਇਹ ਵੀ ਲੱਗਦੀ ਹੈ ਕਿ ਇਸ ਜ਼ਿਲ੍ਹੇ ਦੇ ਵਿੱਚ ਜਿਹੜੇ ਬੱਚੇ ਨੇ ਬੱਚੇ ਜਿਨ੍ਹਾਂ ਦੀ ਉਮਰ ਕੋਈ ਬਾਈ ਚੌਵੀ ਪੱਚੀ ਸਾਲ ਦੀ ਹੋਏਗੀ ਆਪਣੀ ਜਿਹੜੀ ਵਿੱਦਿਆ ਹੈ ਉਹਨੂੰ ਗ੍ਰਹਿਣ ਕਰਨ ਤੋਂ ਬਾਅਦ ਉਹਨਾਂ ਸਾਰਿਆਂ ਨੇ ਕੋਈ ਨਾ ਕੋਈ ਛੋਟਾ ਮੋਟਾ ਨੌਕਰੀ ਦਾ ਜੁਗਾੜ ਉਹਨਾਂ ਨੇ ਆਪਣੇ ਲਈ ਜਿਹੜਾ ਕੀਤਾ ਹੋਇਆ ਹੈ ਵਿਹਲੇ ਉਹ ਨਹੀਂ ਬਹਿੰਦੇ ਬਹੁਤ ਸਾਰੇ ਲੋਕ ਨੇ ਇੱਥੇ ਜਿਹੜੇ ਨਿੱਜੀ ਆਪਣੇ ਬਿਜਨਸ ਖੋਲ੍ਹ ਕੇ ਬੈਠੇ ਨੇ ਜਿਵੇਂ ਜਿਨ੍ਹਾਂ ਕੋਲ ਕੋਈ ਅਗਰ ਜੋਬ ਨਹੀਂ ਹੈ ਤਾਂ ਉਹਨਾਂ ਨੇ ਆਪਣੀ ਜਿਹੜੀਆਂ ਅਕੈਡਮੀਆਂ ਨੇ ਉਹ ਖੋਲ੍ਹੀਆਂ ਹੋਈਆਂ ਨੇ ਬਹੁਤ ਸਾਰੀਆਂ ਅਕੈਡਮੀਜ਼ ਨੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਰੌਣਕੀ ਜ਼ਿਲ੍ਹਾ ਹੈ ਲੋਕ ਜਾਗ੍ਰਿਤ ਨੇ ਇਸ ਗੱਲ ਨੂੰ ਸਮਝਦੇ ਨੇ ਕਿ ਕੰਮ ਧੰਦਾ ਕਰਨਾ ਜਿਹੜਾ ਹੈ ਉਹ ਕੋਈ ਮਾੜੀ ਗੱਲ ਨਹੀਂ ਹੈ ਔਰ ਸਾਨੂੰ ਕੰਮ ਧੰਦਾ ਕਰਕੇ ਆਪਣਾ ਜਿਹੜਾ ਨਿਰਬਾਹ ਹੈ ਰੋਜ਼ ਦੇ ਰੋਜ਼ਾਨਾ ਜੀਵਨ ਦਾ ਉਹ ਕਰਨਾ ਚਾਹੀਦਾ ਹੈ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਦੇ ਵਿੱਚ ਪੜ੍ਹਿਆਂ ਲਿਖਿਆਂ ਦੀ ਬੇਰੁਜ਼ਗਾਰੀ ਹੈ ਪਰ ਓਨੀ ਕੁ ਹੀ ਹੈ ਜਿੰਨੀ ਬਾਕੀ ਸਾਰੇ ਥਾਵਾਂ ਦੇ ਉੱਪਰ ਹੈ ਬਾਕੀ ਬੇਰੁਜ਼ਗਾਰੀ ਇਹ ਉਦੋਂ ਤੱਕ ਦੂਰ ਨਹੀਂ ਹੋ ਸਕਦੀ ਜਦੋਂ ਤੱਕ ਸਰਕਾਰ ਜਿਹੜੀ ਹੈ ਉਹ ਪ੍ਰੋਫੈਸ਼ਨਲ ਕੋਰਸਿਸ ਜਿਹੜੇ ਨੇ ਜਾਂ ਐਜੂਕੇਸ਼ਨ ਜਿਹੜਾ ਸਿਸਟਮ ਹੈ ਸਾਡਾ ਵਿੱਦਿਅਕ ਢਾਂਚਾ ਹੈ ਜਦੋਂ ਤੱਕ ਉਹਨੂੰ ਚੰਗੀ ਤਰ੍ਹਾਂ ਬਦਲਿਆ ਨਹੀਂ ਜਾਂਦਾ ਉਦੋਂ ਤੱਕ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਬੇਰੁਜ਼ਗਾਰੀ ਉਹ ਦੂਰ ਨਹੀਂ ਹੋ ਸਕਦੀ ਘੱਟ ਪੜ੍ਹਿਆਂ ਲਿਖਿਆਂ ਦੀ ਜਾਂ ਅਨਪੜ੍ਹਾਂ ਦੀ ਬੇਰੁਜ਼ਗਾਰੀ ਤਾਂ ਇੱਥੇ ਬਹੁਤ ਘੱਟ ਹੈ ਪੜ੍ਹੇ ਲਿਖੇ ਤਬਕੇ ਦੀ ਜਿਹੜੀ ਬੇਰੁਜ਼ਗਾਰੀ ਉਹ ਇੱਥੇ ਬਹੁਤ ਜ਼ਿਆਦਾ ਹੈ ਬਾਕੀ ਰਹੀ ਗੱਲ ਤਰਨ ਤਾਰਨ ਜ਼ਿਲ੍ਹੇ ਦੀ ਤੋਂ ਸਾਰੇ ਲੋਕ ਜਿਹੜੇ ਨੇ ਇੱਥੋਂ ਦੇ ਕਿਸੇ ਨਾ ਕਿਸੇ ਕੰਮ ਧੰਦੇ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਵਿਅਸਥ ਰੱਖਦੇ ਨੇ ਆਪਣੇ ਜੀਵਨ ਦਾ ਨਿਰਬਾਹ ਉਹ ਆਪਣੇ ਕੰਮ ਧੰਦਿਆਂ ਦਾ ਕਰਕੇ ਹੀ ਕਰਦੇ ਨੇ